ਮੇਰੇ ਖਿਆਲ ਮੁਤਾਬਿਕ ਪੰਜਾਬੀ ਭਾਸ਼ਾ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਸੱਭਿਆਚਾਰਕ ਵਿਚਾਰ ਵਟਾਂਦਰੇ ਅਤੇ ਸੰਚਾਰ ਲਈ ਬਹੁਤ ਵਧੀਆ ਭੂਮਿਕਾ ਨਿਭਾ ਸਕਦੀ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਸ਼ੁਰੂ ਹੋਈ ਹੈ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਪਰਮਾਤਮਾ ਦਾ ਪ੍ਰਚਾਰ ਕੀਤਾ ਹੈ ਸੰਸਾਰ 'ਤੇ ਵੱਖ ਵੱਖ ਹਿੱਸਿਆਂ ਦੇ ਵਿੱਚ ਵਿਚਰ ਕੇ ਉਹਨਾਂ ਨੇ ਪੂਰੇ ਹਿੰਦੂ ਜਗਤ ਨੂੰ ਅਤੇ ਮੁਸਲਿਮ ਜਗਤ ਨੂੰ ਪਰਮਾਤਮਾ ਦਾ ਜੋ ਖੇਲ ਸੀ ਉਹ ਸਮਝਾਇਆ ਹੈ ਅਤੇ ਇਸ ਕਰਕੇ ਜੋ ਜਿਹੜੀ ਪੰਜ ਗੁਰਮੁਖੀ ਤੋਂ ਬਾਅਦ ਜਿਹੜੀ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਬਣੀ ਹੈ ਲੋਕਾਂ ਦੀ ਉਹ ਪੰਜਾਬੀ ਉਸ ਨੂੰ ਅਸੀਂ ਪੰਜਾਬੀ ਕਹਿ ਦਿੰਦੇ ਹਾਂ ਕਿਉਂਕਿ ਇਸ ਦੀ ਜਿਹੜੀ ਲਿਪੀ ਹੈ ਉਹ ਗੁਰਮੁਖੀ ਹੈ ਪੰਜਾਬੀ ਭਾਸ਼ਾ ਦੀ ਅਤੇ ਇਸ ਦੇ ਨਾਲ ਅਸੀਂ ਆਪਣੇ ਵੱਖ ਵੱਖ ਇੰਡੀਆ ਦੀਆਂ ਜਿਹੜੀਆਂ ਭਾਰਤ ਦੀਆਂ ਸਟੇਟਾਂ ਨੇ ਉਹਦੇ ਵਿੱਚ ਅਸੀਂ ਵਿਚਾਰ ਵਟਾਂਦਰਾ ਵੀ ਕਰ ਸਕਦੇ ਹਾਂ ਅਤੇ ਜਿਹੜੇ ਸੰਚਾਰ ਹੈ ਜਿਹੜਾ ਕਮਿਊਨੀਕੇਸ਼ਨ ਹੈ ਉਹਦੇ ਵਿੱਚ ਵੀ ਅਸੀਂ ਇਸਦਾ ਵਧੀਆ ਇਸ ਤਰੀਕੇ ਪੰਜਾਬੀ ਜਿਹੜੀ ਹੈ ਵਧੀਆ ਰੋਲ ਨਿਭਾ ਸਕਦੀ ਹੈ